ਹਾਂਜੀ ਮੈਂ ਯੋਗਾ ਸਿੱਖਣ ਲਈ ਕਈ ਚੈਨਲ ਦੇਖਦਾ ਹਾਂ ਅੱਜ ਕੱਲ੍ਹ ਇੰਟਰਨੈਟ ਉੱਤੇ ਯੋਗਾ ਸਿੱਖਣ ਲਈ ਬਹੁਤ ਸਾਰੇ ਸਰੋਤ ਉਪਲਬਧ ਹਨ ਅਤੇ ਯੂਟੀਊਬ ਚੈਨਲ ਉਹਨਾਂ ਵਿੱਚੋਂ ਇੱਕ ਹਨ ਮੈਂ ਉਹਨਾਂ ਚੈਨਲਾਂ ਨੂੰ ਤਰਜੀਹ ਦਿੰਦਾ ਹਾਂ ਜੋ ਯੋਗਾ ਨੂੰ ਸਹੀ ਅਤੇ ਸੁਰੱਖਿਤ ਤਰੀਕੇ ਨਾਲ ਸਿਖਾਉਂਦੇ ਹਨ ਅਤੇ ਜਿਹਨਾਂ ਵਿੱਚ ਵੱਖ ਵੱਖ ਪੱਧਰਾਂ ਦੇ ਯੋਗੀਆਂ ਲਈ ਸਮੱਗਰੀ ਮੌਜੂਦ ਹੈ ਭਾਵ ਸ਼ੁਰੂਆਤੀ ਵਿਚਕਾਰਲੇ ਅਤੇ ਉੱਨਤ ਪੱਧਰ 'ਤੇ ਯੋਗੀ ਮੈਂ ਇਹ ਵੀ ਵੇਖਦਾ ਹਾਂ ਕਿ ਚੈਨਲ ਯੋਗਾ ਦੇ ਵੱਖ ਵੱਖ ਰੂਪਾਂ ਜਿਵੇਂ ਕਿ ਹੱਠ ਯੋਗਾ ਬਿਨਿਆਸਾ ਯੋਗਾ ਅਸ਼ਟਾਂਗ ਯੋਗਾ ਆਦਿ ਬਾਰੇ ਜਾਣਕਾਰੀ ਦਿੰਦੇ ਹਨ ਯੋਗਾ ਸਿੱਖਣ ਦੇ ਪ੍ਰਕਿਰਿਆ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਭ ਤੋਂ ਪਹਿਲਾਂ ਸਹੀ ਤਕਨੀਕ ਨਾਲ ਯੋਗਾ ਆਸਣ ਕਰਨਾ ਮੁਸ਼ਕਿਲ ਹੋ ਸਕਦਾ ਹੈ ਯੋਗਾ ਵਿੱਚ ਸਰੀਰ ਨੂੰ ਖਿੱਚਣਾ ਮੋੜਨਾ ਅਤੇ ਸੰਤੁਲਨ ਬਣਾਉਣਾ ਸ਼ਾਮਿਲ ਹੁੰਦਾ ਹੈ ਜਿਸ ਲਈ ਸਰੀਰਕ ਯੋਗਤਾ ਅਤੇ ਜਾਗਰੂਕਤਾ ਦੀ ਲੋੜ ਹੁੰਦੀ ਹੈ ਗਲਤ ਤਰੀਕੇ ਨਾਲ ਆਸਨ ਕਰਨ ਨਾਲ ਸੱਟ ਲੱਗਣ ਦਾ ਖਤਰਾ ਹੋ ਸਕਦਾ ਹੈ ਇਸ ਲਈ ਸ਼ੁਰੂਆਤ ਵਿੱਚ ਕਿਸੇ ਯੋਗ ਅਧਿਆਪਕ ਦੀ ਮਦਦ ਲੈਣੀ ਜਾਂ ਚੰਗੇ ਚੈਨਲਾਂ ਤੋਂ ਸਿੱਖਣਾ ਬਹੁਤ ਹੀ ਮਹੱਤਵਪੂਰਨ ਹੈ ਦੂਜਾ ਯੋਗਾ ਕਰਨ ਲਈ ਸਬਰ ਅਤੇ ਨਿਰੰਤਰਤਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਯੋਗਾ ਕੋਈ ਤੁਰੰਤ ਨਤੀਜਾ ਦੇਣ ਵਾਲੀ ਕਸਰਤ ਨਹੀਂ ਹੈ ਇਸ ਦੇ ਲਾਭਾਂ ਨੂੰ ਮਹਿਸੂਸ ਕਰਨ ਲਈ ਨਿਯਮਿਤ ਅਭਿਆਸ ਕਰਨਾ ਪੈਂਦਾ ਹੈ ਕਈ ਲੋਕ ਜਲਦੀ ਨਤੀਜੇ ਚਾਹੁੰਦੇ ਹਨ ਅਤੇ ਜਦੋਂ ਉਹਨਾਂ ਨੂੰ ਤੁਰੰਤ ਨਤੀਜੇ ਨਹੀਂ ਮਿਲਦੇ ਤਾਂ ਉਹ ਨਿਰਾਸ਼ ਹੋ ਜਾਂਦੇ ਹਨ ਅਤੇ ਯੋਗਾ ਕਰਨਾ ਛੱਡ ਦਿੰਦੇ ਹਨ ਇਸ ਲਈ ਯੋਗਾ ਦੀ ਪ੍ਰਕਿਰਿਆ ਵਿੱਚ ਧੀਰਜ ਰੱਖਣਾ ਅਤੇ ਲੰਬੇ ਸਮੇਂ ਤੱਕ ਇਸ ਨੂੰ ਜਾਰੀ ਰੱਖਣਾ ਬਹੁਤ ਹੀ ਜ਼ਰੂਰੀ ਹੈ ਤੀਜਾ ਅੱਜ ਕੱਲ੍ਹ ਦੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਯੋਗਾ ਕਰਨ ਲਈ ਸਮਾਂ ਕੱਢਣਾ ਬਹੁਤ ਹੀ ਮੁਸ਼ਕਿਲ ਹੋ ਸਕਦਾ ਹੈ ਲੋਕਾਂ ਕੋਲ ਕੰਮ ਪਰਿਵਾਰ ਅਤੇ ਹੋਰ ਜਿੰਮੇਵਾਰੀਆਂ ਹੁੰਦੀਆਂ ਹਨ ਜਿਸ ਕਾਰਨ ਉਹਨਾਂ ਲਈ ਯੋਗਾ ਕਰਨ ਲਈ ਸਮਾਂ ਕੱਢਣਾ ਚੁਣੌਤੀਪੂਰਨ ਹੋ ਸਕਦਾ ਹੈ